ਪੰਜਾਬੀ ਭਾਸ਼ਾ ਦੀ ਵਰਤੋਂ ਸਥਾਨਕ ਆਰਥਿਕਤਾ ਵਿੱਚ ਕਈ ਤਰ੍ਹਾਂ ਤੋਂ ਮਹੱਤਵਪੂਰਨ ਹੈ ਇਹ ਭਾਸ਼ਾ ਪੰਜਾਬ ਦੇ ਲੋਕ ਸੰਸਕ੍ਰਿਤ ਅਤੇ ਵਣਜ ਵਪਾਰ ਦੇ ਲੀ ਲਈ ਇੱਕ ਮੁੱਖ ਮਾਧਿਅਮ ਹੈ ਹੇਠਲੇ ਕੁਝ ਤਰੀਕੇ ਹਨ ਜਿਹਨਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਸਥਾਨਕ ਆਰਥਿਕਤਾ ਵਿੱਚ ਕੀਤੀ ਜਾਂਦੀ ਹੈ ਵਣਜ ਵਪਾਰ ਪੰਜਾਬੀ ਭਾਸ਼ਾ ਵਣਜ ਅਤੇ ਵਪਾਰ ਵਿੱਚ ਇੱਕ ਮਹੱਤਵਪੂਰਨ ਭਾਸ਼ਾ ਹੈ ਪੰਜਾਬੀ ਭਾਸ਼ਾ ਵਿੱਚ ਕਾਰੋਬਾਰੀ ਸੰਵਾਦ ਹੋਣ ਦੇ ਕਾਰਨ ਇਹ ਬਿਜਨਸ ਦੀ ਭਾਸ਼ਾ ਤੌਰ 'ਤੇ ਵੀ ਜਾਣੀ ਜਾਂਦੀ ਹੈ ਸਥਾਨਕ ਵਣਜਾਰੀ ਸੰਗਠਨਾਂ ਵਿੱਚ ਵੱਖ ਵੱਖ ਭਾਗ ਵਜੋਂ ਮੈਂਬਰਾਂ ਦੁਆਰਾ ਵਰਤੋਂ ਕੀਤੀ ਜਾਂਦੀ ਹੈ ਇਹ ਵਣਜ ਅਤੇ ਮਾਧਿਅਮ ਵਿੱਚ ਸਥਿਰਤਾ ਲਿਆਉਂਦੀ ਹੈ

ਸਮਾਜਿਕ ਸੰਸਕ੍ਰਿਤਕ ਅਤੇ ਮਨੋਰੰਜਨ ਪੰਜਾਬੀ ਭਾਸ਼ਾ ਸਮਾਜਿਕ ਸੰਸਕ੍ਰਿਤਕ ਅਤੇ ਮਨੋਰੰਜਨ ਦੇ ਅਹਿਮ ਹਿੱਸੇ ਵਜੋਂ ਵੀ ਉਪਯੋਗ ਹੁੰਦੀ ਹੈ ਫੈਸ਼ਨ ਫਿਲਮ ਦੀ ਕਵਿਤਾ ਕਹਾਣੀਆਂ ਨਾਟਕ ਅਤੇ ਹਮਜ ਉਹਤੇਮਾ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਵਰਤੋਂ ਪੰਜਾਬੀ ਮਨੋਰੰਜਨ ਉਹਤੋਮਾ ਨੂੰ ਵਿਕਸਿਤ ਅਤੇ ਸੁਰਜੀਤ ਕਰਦੀ ਹੈ ਸਰਕਾਰੀ ਸਥਾਨਕ ਉਦਯੋਗਾਂ ਅਤੇ ਸੇਵਾਵਾਂ ਪੰਜਾਬ ਸਰਕਾਰ 'ਤੇ ਆਧਾਰਿਤ ਸੇਵਾਵਾਂ ਜਿਵੇਂ ਕਿ ਸਿੱਖਿਆ ਸਿਹਤ ਤਨਖਾਹ ਆਦਿ ਵੀ ਪੰਜਾਬੀ ਭਾਸ਼ਾ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ ਇਹ ਸਥਾਨਕ ਜਨਤਾ ਵਿੱਚ ਸਮਝ ਪੈਦਾ ਕਰਦੀ ਹੈ ਅਤੇ ਸਰਕਾਰ ਦੀ ਨੀਤੀਆਂ ਅਤੇ ਯੋਜਨਾ ਵੀ ਬਣਾਉਣ ਵਿੱਚ ਮਦਦ ਕਰਦੀ ਹੈ